ਹੈਲੋ ਹਾਂਜੀ ਗੁਰਪ੍ਰੀਤ ਸਿੰਘ ਜੀ ਬੋਲ ਰਹੇ ਜੀ ਸਿੰਘ ਸਭਾ ਗੁਰਦੁਆਰੇ ਤੋਂ ਹਾਂਜੀ ਮੈਂ ਦਰਪਨ ਬੋ ਪ੍ਰੀਤ ਬੋਲ ਰਿਹਾ ਜੀ ਮੈਂ ਇੱਥੇ ਕਨੇਡਾ ਤੋਂ ਆਪਣੇ ਪਰਿਵਾਰ ਨਾਲ ਇੱਧਰ ਘੁੰਮਣ ਆਇਆ ਸੀ ਪੰਜਾਬ ਅਤੇ ਮੈਂ ਮੈਂ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਗੋ ਗੁਰਦੁਆਰੇ ਹੀ ਰਹਿ ਰਿਹਾ ਅਤੇ ਇੱਥੇ ਹੀ ਲੰਗਰ ਛੱਕ ਰਿਹਾ ਜੀ ਮੈਨੂੰ ਤੁਹਾਡੇ ਇੱਥੇ ਦਾ ਪ੍ਰਬੰਧ ਕਾਫ਼ੀ ਵਧੀਆ ਲੱਗਿਆ ਜੀ ਅਤੇ ਮੈਨੂੰ ਬਹੁਤ ਮਦਦ ਮਿਲੀ ਆ ਇਹਦੇ ਨਾਲ ਹਾਂਜੀ ਅਤੇ ਮੈਂ ਉਹੀ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਪਾਉਣਾ ਚਾਹੁੰਦਾ ਜੀ ਅਤੇ ਬਾਕੀ ਹੋਰ ਵੀ ਕਿਤੇ ਜੇ ਜ ਜ਼ਰੂਰਤ ਹੋਵੇ ਮੈਂ ਆਪਣੇ ਵੱਲੋਂ ਪੂਰੀ ਮਦਦ ਕਰਨਾ ਚਾਹੁੰਦਾ ਜੀ ਠੀਕ ਹੈ ਜੀ ਜ਼ਰੂਰ ਜੀ ਮੈਂ ਜ਼ਰੂਰ ਆਵਾਂਗਾ ਅਤੇ ਆਪਣੇ ਵੱਲੋਂ ਜਿੰਨਾ ਹੋ ਸਕਦਾ ਮੈਂ ਆਪਣੀ ਸੇਵਾ ਪਾ ਕੇ ਜਾਵਾਂਗਾ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਵੀ